ਮੈਂ ਫਪਿੱਟਕਾਟ ਤੋਂ ਬੋਟ ਏਅਰਬੋਟ ਇੱਕ ਸੌ ਬੱਤੀ ਓਡਰ ਕੀਤੇ ਸੀਗੇ ਜਿਹੜੇ ਕਿ ਸੁਣਨ ਦੇ ਵਿੱਚ ਬਹੁਤ ਹੀ ਜ਼ਿਆਦਾ ਉਨ੍ਹਾਂ ਦੀ ਜਿਹੜੀ ਕੁਐਲਿਟੀ ਉਹ ਬਹੁਤ ਜ਼ਿਆਦਾ ਬੇਕਾਰ ਹੈ ਮੇਰੇ ਕੰਨਾਂ ਦੇ ਵਿੱਚ ਦਰਦ ਕਰਨ ਲੱਗ ਜਾਂਦਾ ਅਤੇ ਬੈਟਰੀ ਬੈਕਅੱਪ ਵੀ ਬਹੁਤ ਜ਼ਿਆਦਾ ਘੱਟ ਹੈ ਅਤੇ ਮੈਨੂੰ ਇਨ੍ਹਾਂ ਨੂੰ ਜ਼ੂਜ ਯੂਜ਼ ਕਰਨ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਪੈਸਿਆਂ ਦੀ ਇਹ ਇੱਕ ਪੈਸੇ ਹੀ ਗਾਲੇ ਹਨ ਇਨ੍ਹਾਂ ਨੂੰ ਲੈ ਕੇ